ਇੱਕ ਕਿਤਾਬ ਜਿਸ ਨੇ ਮੈਨੂੰ ਬੌਧਿਕ ਤੌਰ 'ਤੇ ਚੁਣੌਤੀ ਦਿੱਤੀ ਹੈ ਉਹ ਉੱਨੀ ਸੌ ਚੁਰਾਸੀ ਜੋਰਜ ਔਰਵਿਲ ਦੁਆਰਾ ਇਸ ਕਿਰਤ ਨੇ ਮੈਨੂੰ ਆਧੁਨਿਕ ਸਮਾਜ ਅਤੇ ਰਾਜਨੀਤਿਕ ਪ੍ਰਣਾਲੀ ਬਾਰੇ ਬਹੁਤ ਕੁਛ ਪੁੱਛਣ ਲਈ ਪ੍ਰੇਰਿਤ ਕੀਤਾ ਇਹਦੀਆਂ ਚੁਣੌਤੀਆਂ ਇਹ ਹਨ ਟਿਕਾਣਾ ਅਤੇ ਨਿਗਰਾਨੀ ਕਹਾਣੀ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਰਕਾਰ ਨਾਗਰਿਕਾਂ ਦੀ ਜ਼ਿੰਦਗੀ 'ਤੇ ਪੂਰੀ ਤਰ੍ਹਾਂ ਨਿਯੰਤਰਕ ਕਰਦੀ ਹੈ ਉਹਨਾਂ ਦੀ ਹਰ ਗਤੀਵਿਧੀ 'ਤੇ ਨਿਗਰਾਨੀ ਰੱਖਦੀ ਹੈ ਇਹ ਵਿਚਾਰ ਬਹੁਤ ਚਿੰਤਾਜਨਕ ਵਾਲਾ ਹੈ ਕਿਉਂਕਿ ਇਹ ਮਾਨਸਿਕ ਆਜ਼ਾਦੀ ਦੇ ਨਿੱਜੀ ਜੀਵਨ ਦੇ ਅਧਿਕਾਰਾਂ 'ਤੇ ਸਵਾਲ ਖੜ੍ਹੇ ਕਰਦਾ ਹੈ ਸੋਚ ਦੇ ਨਿਰੰਤਰਨ ਦਾ ਅਸਰ ਦੱਬੋ ਅਤੇ ਡਬਲਥਿੰਗ ਵਰਗੇ ਸਮਾਜਿਕ ਅਤੇ ਮਗੋ ਮਨੋਵਿਗਿਆਨਕ ਨਿਰੰਤਰਨ ਦੇ ਇੱਕ ਕਹਾਣੀ ਦੇ ਕੇਂਦਰ ਵਿੱਚ ਹਨ ਇਹਨਾਂ ਵਿਚਾਰਾਂ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਸੀਂ ਕਿੰਨੇ ਹੱਦ ਤੱਕ ਆਪਣੀ ਸੋਚ ਅਤੇ ਵਿਚਾਰਾਂ ਨੂੰ ਖੁਦ ਕੰਟਰੋਲ ਕਰ ਸਕਦੇ ਹਾਂ